ਵਹਿਮ ਭਰਮ ਅਜੌਕੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਆਮ ਤੌਰ 'ਤੇ ਪ੍ਰਚੱਲਿਤ ਵਹਿਮ ਭਰਮਾਂ ਵਿੱਚ ਅਗਰ ਸਵੇਰੇ ਸਵੇਰੇ ਕੋਈ ਮੱਥੇ ਲੱਗ ਜਾਵੇ ਬਿੱਲੀ ਰਸਤਾ ਕੱਟ ਜਾਵੇ ਕੋਈ ਨਿੱਛ ਮਾਰ ਦੇਵੇ ਜਾਂ ਇਹੋ ਜਿਹੇ ਹੋਰ ਕਈ ਤਰ੍ਹਾਂ ਦੇ ਵਹਿਮ ਭਰਮ ਜੋ ਜਿਹਨਾਂ 'ਤੇ ਲੋਕ ਬੜੀ ਮਜਬੂਤੀ ਨਾਲ ਵਿਸ਼ਵਾਸ ਕਰਦੇ ਹਨ